ਗੱਤਕਾ ਸਿੱਖਣ ਦੀ ਇੱਕ ਮਾਰਸ਼ਲ ਆਰਟ ਆ ਜਿਸ ਵਿੱਚ ਕੁੜੀਆਂ ਨੂੰ ਇਕੱਲੇ ਮੁੰਡਿਆਂ ਨੂੰ ਗੱਤਕਾ ਨਹੀਂ ਸਿਖਾਇਆ ਜਾਂਦਾ ਅੱਜ ਕੱਲ ਕੁੜੀਆਂ ਵੀ ਗੱਤਕਾ ਸਿੱਖ ਰਹੀਆਂ ਹਨ ਮੁੰਡਿਆਂ ਵਿੱਚ ਗੱਤਕਾ ਇੱਕ ਪ੍ਰੋਪਰ ਡਰੈਸ ਵਿੱਚ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਕਮਰਕੱਸਾ ਬੰਨ੍ਹ ਕੇ ਚੋਲਾ ਪਹਿਨਾ ਕੇ ਉਸ ਤਰ੍ਹਾਂ ਹੀ ਕੁੜੀਆਂ ਨੂੰ ਵੀ ਗੱਤਕਾ ਸਿਖਾਉਣ ਲਈ ਇੱਕ ਪ੍ਰੋਪਰ ਇੱਕ ਖਾਸ ਡਰੈਕਸ ਪਹਿਨਾਈ ਜਾਂਦੀ ਹੈ ਉਹ ਡਰੈਸ ਵਿੱਚ ਇਹੋ ਜਿਹੀ ਡਰੈਸ ਪਹਿਨਾਈ ਜਾਂਦੀ ਹੈ ਜਿਸ ਵਿੱਚ ਕੁੜੀਆਂ ਦੇ ਕਿਸੇ ਵੀ ਤਰ੍ਹਾਂ ਦਾ ਅੰਗ ਦਾ ਪ੍ਰਦਰਸ਼ਨ ਨਾ ਹੋਵੇ ਕਿ ਖੁੱਲ੍ਹੀ ਡਰੈਸ ਪਹਿਨਾਈ ਜਾਂਦੀ ਹੈ ਇੰਨੀ ਵੀ ਖੁੱਲ੍ਹੀ ਨਹੀਂ ਹੁੰਦੀ ਕਿ ਮੰਨ ਲਉ ਗੱਤਕਾ ਖੇਡਦਿਆਂ ਉਹ ਕਿਸੇ ਸ਼ਸਤਰ ਦੇ ਸੰਪਰਕ ਵਿੱਚ ਆਵੇ ਕਿਸੇ ਸ਼ਸਤਰ ਦੇ ਸੰਪਰਕ ਵਿੱਚ ਆਵੇ ਇਸ ਤਰ੍ਹਾਂ ਹੀ ਕੁੜੀਆਂ ਅਤੇ ਮੁੰਡਿਆਂ ਦੀ ਜਿਹੜੀ ਗੱਤਕਾ ਸਿਖਲਾਈ ਹੈ ਉਸ ਵਿੱਚ ਡਰੈਸ ਦੇ ਤੌਰ 'ਤੇ ਵੀ ਵੱਖਰਤਾ ਹੁੰਦੀ ਹੈ